ਪੰਜਾਬ ਦੇ ਵਿੱਚ ਪ੍ਰਮੁੱਖ ਸਪੋਰਟਸ ਟੀਮਾਂ ਜਿਹੜੀਆਂ ਹੈਗੀਆਂ ਹਨ ਮੇਨਲੀ ਤਾਂ ਇੱਥੋਂ ਦੇ ਬੱਚਿਆਂ ਨੂੰ ਕ੍ਰਿਕਟ ਕੱਬਡੀ ਇਹਦੇ ਵਿੱਚ ਬਹੁਤ ਹੀ ਰੁਝਾਨ ਹੈ ਜੇ ਆਪਾਂ ਦੇਖੀਏ ਤਾਂ ਜਗ੍ਹਾ ਜਗ੍ਹਾ 'ਤੇ ਕ੍ਰਿਕਟ ਅਕਾ ਅਕਾਦਮੀਆਂ ਖੁੱਲੀਆਂ ਹੋਈਆਂ ਜੇ ਆਪਾਂ ਪਟਿਆਲੇ ਦਾ ਹੀ ਦੇਖੀਏ ਜਿਸ ਤਰ੍ਹਾਂ ਕਿ ਅਰਬਨ ਅਸਟੇਟ ਹੈ ਇਹਦੇ 'ਚ ਕ੍ਰਿਕਟ ਅਕਾਦਮੀ ਹੈ ਫਿਰ ਆਪਾਂ ਗੁਰੂ ਨਾਨਕ ਨਗਰ ਦੇਖ ਲਈਏ ਉੱਥੇ ਨਿਕਸ ਕ੍ਰਿਕੇਟ ਅਕਾਦਮੀ ਹੈ ਇਸੇ ਤਰ੍ਹਾਂ ਇੱਕ ਹੋਰ ਵਨ ਕ੍ਰਿਕਟ ਅਕਾਦਮੀ ਹੈ ਪਟਿਆਲੇ ਦੇ ਵਿੱਚ ਘੱਟੋ ਘੱਟ ਛੇ ਸੱਤ ਕ੍ਰਿਕਟ ਅਕਾਦਮੀਆਂ ਹਨ ਜੇ ਤੁਸੀਂ ਦੇਖ ਰਹੇ ਹੋ ਕਿ ਸਕੂਲ ਤੋਂ ਹੀ ਬੱਚੇ ਜਦੋਂ ਤੀਸਰੀ ਚੌਥੀ ਵਿੱਚ ਪੜ੍ਹ ਪੜ੍ਹਦੇ ਹੁੰਦੇ ਹਨ ਤਾਂ ਉਹ ਕ੍ਰਿਕਟ ਵਾਲੀਆਂ ਟੀ ਸ਼ਰਟਾਂ ਲੈ ਕੇ ਤੇ ਵੀ ਅਸੀਂ ਤਾਂ ਕ੍ਰਿਕਟ ਹੀ ਖੇਡਣੀ ਹੈ ਛੋਟੇ ਹੁੰਦੇ ਤੋਂ ਬੈਟ ਲੈਣਾ ਸ਼ੁਰੂ ਕਰਦੇ ਹਨ ਤਾਂ ਹਰ ਇੱਕ ਸਾਲ ਉਹਨਾਂ ਦੇ ਬੈਟ ਦਾ ਸਾਈਜ਼ ਵੱਡਾ ਹੋਈ ਜਾਂਦਾ ਕ੍ਰਿਕਟ ਖੇਡਣਾ ਬਹੁਤ ਹੀ ਪਸੰਦ ਕਰਦੇ ਹਨ ਕਦੇ ਵਿਰਾਟ ਕੋਹਲੀ ਦੀ ਨਕਲ ਕਰਦੇ ਹੈ ਕਦੇ ਰੋਹਿਤ ਸ਼ਰਮੇ ਦੀ ਨਕਲ ਕਰਦੇ ਹੈ ਕਦੇ ਧੋਨੀ ਦੀ ਨਕਲ ਕਰਦੇ ਹੈ ਤਾਂ ਕ੍ਰਿਕਟ ਬੱਚੇ ਖੇਡਣਾ ਬਹੁਤ ਪਸੰਦ ਕਰਦੇ ਹੈ ਨਾਲ ਨਾਲ ਹੀ ਹੁਣ ਕਬੱਡੀ ਵੱਲ ਵੀ ਬਹੁਤ ਰੁਝਾਨ ਹੋ ਰਿਹਾ ਜਦੋਂ ਟੀ ਵੀ ਜਦੋਂ ਤੋਂ ਟੀ ਵੀ 'ਤੇ ਕਬੱਡੀ ਦੇ ਸ਼ੋਅ ਆਉਣੇ ਸ਼ੁਰੂ ਹੋਏ ਆ ਉਦੋਂ ਤੋਂ ਬੱਚਿਆਂ ਨੂੰ ਇਹਦੇ ਵਿੱਚ ਇਸ ਗੇਮ ਦੇ ਵਿੱਚ ਵੀ ਕਾਫ਼ੀ ਰੁਝਾਨ ਹੋ ਗਿਆ ਬੈਡਮਿੰਟਨ ਤਾਂ ਬੱਚੇ ਆਮ ਤੌਰ 'ਤੇ ਖੇਡਦੇ ਹਨ ਜਿਹਤੇ ਜਿਹੜੇ ਵੀ ਘਰ ਦੇ ਵਿੱਚ ਦੋ ਭੈਣ ਭਰਾ ਹੈ ਉਹ ਸ਼ਾਮ ਨੂੰ ਆਪਦੇ ਘਰ ਦੇ ਲੋਨ ਵਿੱਚ ਨਿਕਲ ਕੇ ਬਡਮਿੰਟਨ ਖੇਡਣਾ ਵੀ ਬਹੁਤ ਪਸੰਦ ਕਰਦੇ ਹਨ ਫੁਟਬਾਲ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਖਡਾਈ ਜਾਂਦੀ ਹੈ ਜਦੋਂ ਵੀ ਛੁੱਟੀ ਹੁੰਦੀ ਹੈ ਬੱਚੇ ਫੁਟਬਾਲ ਲੈ ਕੇ ਆਪਦਾ ਭੱਜਦੇ ਦੌੜਦੇ ਵਧੀਆ ਫੁਟਬਾਲ ਖੇਡਦੇ ਹਨ ਪਰ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਜੋ ਬੱਚਿਆਂ ਦਾ ਰੁਝਾਨ ਹੈ ਉਹ ਕ੍ਰਿਕਟ ਵੱਲ ਹੈ